ਕੁਛ ਦਿਨਾਂ ਪਹਿਲਾਂ ਮੈਂ ਇੱਕ ਲੈਪਟੋਪ ਔਡਰ ਕੀਤਾ ਸੀ ਫਲਿੱਪਕਾਰਟ ਤੋਂ ਅਤੇ ਫਲਿੱਪਕਾਰਟ ਵਾਲਿਆਂ ਨੇ ਵੀ ਬਹੁਤ ਵਧੀਆ ਤਰ੍ਹਾਂ ਧਿਆਨ ਨਾਲ ਡਿਲੀਵਰੀ ਕੀਤੀ ਆ ਅਤੇ ਡਿਲੀਵਰੀ ਬੋਆਏ ਨੇ ਵੀ ਬੜੇ ਧਿਆਨ ਨਾਲ ਘਰ ਲੈਪਟੋਪ ਡਿਲੀਵਰ ਕੀਤਾ ਅਤੇ ਮੈਂ ਲੈਪਟੋਪ ਅਸੂਸ ਕੰਪਨੀ ਦਾ ਕੀਤਾ ਸੀ ਜਿਸ ਦਾ ਆਈ ਸੈਵਨ ਪ੍ਰੋਸੈਸਰ ਆ ਤੇਰਾਂ ਜਨਰੇਸ਼ਨ ਸੀ ਅਤੇ ਗਰਾਫੀ ਕਾਰਡ ਤੀਹ ਪੰਜਾਹ ਟੀ ਆਈ ਸੀ ਅਤੇ ਅੱਠ ਜੀ ਬੀ ਰੈਮ ਸੀ ਅਤੇ ਵਨ ਟੀ ਵੀ ਐੱਸ ਐੱਸ ਡੀ ਸੀ ਜਿਸਦੇ ਬਹੁਤ ਵਧੀਆ ਫੀਚਰ ਸੀ ਅਤੇ ਗੇਮਪਲੇ ਬਹੁਤ ਜ਼ਿਆਦਾ ਹੀ ਸਮੂਥ ਸੀ ਬਹੁਤ ਮਜ਼ਾ ਆਇਆ ਮੇਰੇ ਫਰੈਂਡਸ ਨੂੰ ਵੀ ਬਹੁਤ ਮਜ਼ਾ ਆਇਆ ਖੇਡਣ ਵਿੱਚ ਇਸ ਵਿੱਚ ਮੈਂ ਕੋਡਿੰਗ ਵਗੈਰਾ ਵੀ ਬਹੁਤ ਵਧੀਆ ਤਰੀਕੇ ਨਾਲ ਕਰਦਾ ਜਵਾ ਵਗੈਰਾ ਵੀ ਕਰਦਾ ਅਤੇ ਕ੍ਰੈਸ਼ ਦਾ ਇੱਕ ਇਸ਼ੂ ਨਹੀਂ ਅਤੇ ਇਸ ਵਿੱਚ ਬਹੁਤ ਵਧੀਆ ਫੀਚਰਸ ਨੇ ਇਸ ਵਿੱਚ ਐੱਮ ਐੱਸ ਵਰਡ ਦੇ ਮੈਨੂੰ ਲਾਈਫ ਟਾਈਮ ਦੀ ਕੀ ਦਿੱਤੀ ਗਈ ਹੈ ਜਿਸ ਨਾਲ ਮੈਂ ਆਪਣੇ ਬਹੁਤ ਜ਼ਿਆਦਾ ਕੰਮ ਕਰ ਰਿਹਾ ਸਕਦਾ ਹਾਂ ਇਸ ਵਿੱਚ ਕੂਲਿੰਗ ਫੈਨ ਬਹੁਤ ਵਧੀਆ ਤਰੀਕੇ ਨਾਲ ਵਰਕ ਕਰ ਰਹੇ ਹਨ ਇਸ ਨਾਲ ਮੈਨੂੰ ਮਾਊਸ ਵੀ ਦਿੱਤਾ ਗਿਆ ਹੈ ਇੱਕ ਬੈਗ ਵੀ ਦਿੱਤਾ ਗਿਆ ਹੈ ਅਤੇ ਨਾਲ ਇੱਕ ਏਅਰਬਡ ਗਿਫਟ ਦਿੱਤਾ ਗਿਆ ਜਿਸ ਨਾਲ ਏਅਰਬਡ ਦੀ ਸਾਊਂਡ ਕੁਆਲਿਟੀ ਬਹੁਤ ਵਧੀਆ ਬਹੁਤ ਹੀ ਜ਼ਿਆਦਾ ਵਧੀਆ ਅਸੂਸ ਕੰਪਨੀ ਦਾ ਲੈਪਟੋਪ ਬਹੁਤ ਹੀ ਜ਼ਿਆਦਾ ਗੁੱਡ ਲੁਕਿੰਗ ਗਿਆ ਅਤੇ ਸਮੂਥਨੈਂਸ ਹੈ ਬਹੁਤ ਜ਼ਿਆਦਾ ਅਤੇ ਜ਼ਿਆਦਾ ਹੈਵੀ ਵੇਟ ਵੀ ਨਾ ਕੋਈ ਨੈਗਟਿਵ ਪੁਆਇੰਟਸ ਨਹੀਂ ਇਹਦੇ